ਹਾਂ ਅਸੀਂ ਮਾਨਸਿਕ ਸਿਹਤ ਸਮੱਸਿਆ ਬਾਰੇ ਬਹੁਤ ਪੜ੍ਹਿਆ ਹੈ ਸਾਨੂੰ ਸਕੂਲ ਵਿੱਚ ਇਹ ਸ ਇਹ ਸਮੱਸਿਆ ਦਾ ਬਾਰੇ ਸਮਝਾਇਆ ਜਾਂਦਾ ਸੀ ਨਵੀਂ ਟੈਕਨੋਲੋਜੀ ਆਉਣ ਦੇ ਨਾਲ ਮਾਨਸਿਕ ਰੋਗਾਂ ਵਿੱਚ ਵਾਧਾ ਹੋਇਆ ਇਸ ਤ ਇਸ ਨਾਲ ਜਿਵੇਂ ਕੰਮ ਕੰਮ ਜ਼ਿਆਦਾ ਦੇਰ ਤੱਕ ਕੰਪਿਊਟਰ ਜ਼ਿਆਦਾ ਦੇਰ ਤੱਕ ਕੰਪਿਊਟਰ ਉੱਤੇ ਕੰਮ ਕਰਨ ਨਾਲ ਸਾਡਾ ਮਾਨਸਿਕ ਸੰਤੁਲਤ ਵਿਗੜਦਾ ਹੈ ਇਸ ਨਾਲ ਸਾਨੂੰ ਕਈ ਤਰ੍ਹਾਂ ਦੇ ਡਿਪਰੈਸ਼ਨ ਆਦਿ ਆਦਿ ਆਦਿ ਆਦਿ ਅਦਾ ਆਦਿ ਬਿਮਾਰੀਆਂ ਲੱਗਦੀਆਂ ਹਨ ਏਨ ਰੋਗ ਇਹਨਾਂ ਰੋਗਾਂ ਤੋਂ ਬਾਹਰ ਆਉਣ ਲਈ ਸਰਕਾਰ ਨੇ ਬਹੁਤ ਸਾਰੇ ਕੇਂਦਰ ਖੋਲ੍ਹੇ ਹਨ ਇਹਨਾਂ ਇਹ ਹਰਸ਼ ਜ਼ਿਲ੍ਹੇ ਵਿੱਚ ਇੱਕ ਨਾ ਇੱਕ ਕੇਂਦਰ ਹੁੰਦਾ ਹੈ ਜੋ ਸਾਨੂੰ ਇਨ੍ਹਾਂ ਰੋਗਾਂ ਬਾਰੇ ਦੱਸਦਾ ਹੈ ਇਸ ਇਸ ਇਸੇ ਇਹ ਗੰਭੀਰ ਸਮੱਸਿਆਵਾਂ ਪੈਦਾ ਕਰਦਾ ਹੈ ਸਮਾਜ ਨੂੰ ਪਰ ਕਈ ਲੋਕ ਇਹ ਸਮਾਜ ਨੂੰ ਦੱਸਣ ਦੱਸਣਾ ਜ਼ਰੂਰੀ ਨਹੀਂ ਸਮਝਦੇ ਜਾਂ ਉਹਨਾਂ ਤੋਂ ਲੁਕਾਉਂਦੇ ਹਨ ਅਤੇ ਉਹ ਇਕੱਲਾ ਰਹਿਣਾ ਜਾਂ ਡਿਪਰੈਸ਼ਨ ਵਿੱਚ ਰਹਿਣਾ ਰਹਿਣਾ ਰਹਿ ਜਾਂਦੇ ਹਨ ਅਤੇ ਉਨਾਂ ਨੂੰ ਕਈ ਤਰ੍ਹਾਂ ਦੇ ਰੋਗ ਜਿਵੇਂ ਡਿਪਰੈਸ਼ਨ ਦਾ ਰੋਗ ਅੱਜ ਕੱਲ੍ਹ ਬਹੁਤ ਚੱਲਿਆ ਹੈ ਇਸ ਨਾਲ ਚਿੰਤਾ ਅਤੇ ਉਦਾਸੀ ਨਾਲ ਦਿਮਾਗ ਵਿੱਚ ਸਟਰੈਸ ਹੁੰਦਾ ਹੈ ਉਹਨਾਂ ਉਹ ਹੋਰ ਲੋਕਾਂ ਨਾਲ ਸ਼ੇਅਰ ਕਰਨਾ ਨਹੀਂ ਪਸੰਦ ਕਰਦੇ ਇਸ ਇਸ ਤਰ੍ਹਾਂ ਉਹਨਾਂ ਨੂੰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ